ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਇੱਥੇ ਕਾਫ਼ੀ ਮੋਹਾਲੀ ਮੋਹਾਲੀ 'ਚ ਕਾਫ਼ੀ ਗੁਰਦੁਆਰਾ ਸਾਹਿਬ ਹੈ ਜੀ ਇੱਕ ਤਾਂ ਸੋਹਾਣਾ ਸਿੰਘ ਸ਼ਹੀਦਾਂ ਸਾਹਿਬ ਹੈ ਜੀ ਇੱਥੇ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਜੀ ਹਨੂੰਮਾਨ ਸਿੰਘ ਜੀ ਸ਼ਹੀਦ ਹੋਏ ਸੀ ਇੱਥੇ ਹਾਂਜੀ ਸ਼ਹੀਦੀ ਗੁਰਦੁਆਰਾ ਹੈ ਜੀ ਇੱਥੇ ਇਹ ਏਅਰਪੋਰਟ ਰੋਡ ਏਅਰਪੋਰਟ ਰੋਡ 'ਤੇ ਹੈ ਜੀ ਹਾਂ ਚੰਡੀਗੜ੍ਹ ਤੋਂ ਤੁਸੀਂ ਬਾਏ ਬੱਸ ਵੀ ਆ ਸਕਦੇ ਹੈ ਬਾਏ ਕਾਰ ਵੀ ਆ ਸਕਦੇ ਹੈ ਬਾਏ ਆਟੋ ਵੀ ਆ ਸਕਦੇ ਹੈ ਜੀ

ਗੁਰਦੁਆਰਾ ਸੋਹਾਣਾ ਸਿੰਘ ਸ਼ਹੀਦਾਂ ਸਾਹਿਬ ਹੀ ਕਹਿ ਦਿਉ ਜੀ ਉੱਥੇ ਹੀ ਉਤਾਰ ਦੇਣਗੇ ਤੁਹਾਨੂੰ ਤੁਸੀਂ ਉੱਥੋਂ ਕੈਬ ਲੈ ਕੇ ਵੀ ਆ ਸਕਦੇ ਹੈ ਜੀ ਹਾਂਜੀ ਹਾਂਜੀ ਕਮਰਿਆਂ ਦਾ ਪ੍ਰਬੰਧ ਹੈ ਚੌਵੀ ਘੰਟੇ ਲੰਗਰ ਹੈ ਅੰਦਰ ਪਾਰਕਿੰਗ ਹੈ ਜੀ ਹਾਂਜੀ ਹਾਂਜੀ ਨਾਲ ਹੀ ਅੱਠ ਫੇਸ ਅੱਠ ਫੇਸ ਹੈ ਜੀ ਉਹ ਅੱਠ ਫੇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਬੱਸ ਸਟੈਂਡ ਹੈ ਜੀ ਰਾਤ ਅੱਠ ਵਜੇ ਤੋਂ ਬਾਅਦ ਦਰਸ਼ਨ ਬੰਦ ਹੋ ਜਾਂਦੇ ਹੈ ਜੀ ਵੈਸੇ ਚੌਵੀ ਘੰਟੇ ਖੁੱਲਾ ਹੁੰਦਾ ਹੈ ਪਾਠ ਬੰਦ ਹੋ ਜਾਂਦਾ ਕੀਰਤਨ ਹੁੰਦਾ ਹੈ ਜੀ ਸ਼ਾਮ ਸਵੇਰੇ ਦੋਨੋਂ ਟਾਈਮ ਕੀਰਤਨ ਹੁੰਦਾ ਹੈ ਜੀ ਇੱਥੇ ਹਾਂਜੀ ਲੰਗਰ ਰਾਤ ਨੂੰ ਦਸ ਵਜੇ ਤੱਕ ਚੱਲਦਾ ਹੈ ਜੀ ਦਸ ਵਜੇ ਤੋਂ ਬਾਅਦ ਲੰਗਰ ਬੰਦ ਹੋ ਜਾਂਦਾ ਹੈ ਜੀ ਹਾਂਜੀ ਹਾਂਜੀ ਗੁਰਦੁਆਰਾ ਸੋਹਾਣੇ 'ਚ ਹੀ ਹੈ ਜੀ ਉਹ ਵੀ ਹਾਂਜੀ ਇਹ ਤਾਂ ਬਿਲਕੁਲ ਪੰਜ ਸਿਰਫ ਦਸ ਮਿੰਟ ਦਾ ਰਸਤਾ ਹੀ ਹੈ ਜੀ ਤਿੰਨ ਚਾਰ ਕਿਲੋਮੀਟਰ ਹੀ ਹੋਵੇਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਉਕੇ ਉਕੇ